ਗਾਉਣ ਲਈ ਮਿਊਜ਼ਿਕ ਦੇ ਵਿੱਚ ਮੈਨੂੰ ਵੈਸੇ ਤਾਂ ਸਾਰੇ ਤਰ੍ਹਾਂ ਦੀਆਂ ਸ਼ੈਲੀਆਂ ਪਸੰਦ ਨੇ ਪਰ ਮੇਰੀ ਗਾਇਕੀ ਦਾ ਅੰਦਾਜ਼ ਥੋੜ੍ਹਾ ਜਿਹਾ ਪੰਜਾਬੀ ਫੋਕ ਮਿਊਜ਼ਿਕ ਹੈ ਜਿਵੇਂ ਸਾਡੇ ਪੁਰਾਣੇ ਪੰਜਾਬੀ ਬਹੁਤ ਮਹਾਨ ਸਿੰਗਰਸ ਉਸਤਾਦ ਕੁਲਦੀਪ ਮਾਣਕ ਜੀ ਉਸਤਾਦ ਚਮਕੀਲਾ ਜੀ ਅਤੇ ਸਰਦੂਲ ਸਿਕੰਦਰ ਜੀ ਬਹੁਤ ਜ਼ਿਆਦਾ ਫੋਕ ਗਾਉਂਦੇ ਰਹੇ ਨੇ ਹੇਕਾਂ ਲਾ ਕੇ ਮੈਨੂੰ ਵੀ ਉਸ ਤਰ੍ਹਾਂ ਹੀ ਸਾਡੀ ਠੇਠ ਪੰਜਾਬੀ ਫੋਕ ਸੱਭਿਆਚਾਰ ਗਾਇਕੀ ਬਹੁਤ ਜਿ ਜ਼ਿਆਦਾ ਪਸੰਦ ਆਉਂਦੀ ਜਿਵੇਂ ਪੰਜਾਬੀ ਬੋਲੀਆਂ ਭੰਗੜੇ ਦੀਆਂ ਬੋਲੀਆਂ ਹੋਈਆਂ ਮੈਨੂੰ ਬਹੁਤ ਜ਼ਿਆਦਾ ਇਹਨਾਂ ਵਿੱਚ ਰੁਚੀ ਹੈ ਅਤੇ ਪਰ ਮੈਂ ਕਦੇ ਕਦੇ ਕਲਾਸਿਕ ਹੋ ਗਿਆ ਆਪਣਾ ਮਿਊਜ਼ਿਕ ਸੰਗੀਤ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਜੀ ਹੋ ਗਏ ਉਸ ਤਰ੍ਹਾਂ ਦੀ ਗਾਇਕੀ ਵੀ ਕਦੇ ਕਦੇ ਸੁਣ ਲੈਂਦਾ ਥੋੜ੍ਹੀ ਬਹੁਤੀ ਗਾ ਵੀ ਲੈਂਦਾ ਪਰ ਮੈਨੂੰ ਜ਼ਿਆਦਾਤਰ ਮੇਰਾ ਜਿਹੜਾ ਅੰਦਾਜ਼ ਉਹ ਪੰਜਾਬੀ ਫੋਕ ਮਿਊਜਿਕ ਦਾ ਹੀ ਆ ਮੈਂ ਉਸਤਾਦ ਕੁਲਦੀਪ ਮਾਣਕ ਜੀ ਨੂੰ ਬਹੁਤ ਜ਼ਿਆਦਾ ਸੁਣਦਾ ਕਿਉਂਕਿ ਮੇਰੇ ਰੂਹ ਵਿੱਚ ਉਹ ਬੈਠੀ ਹੋਈ ਆ ਮੈਨੂੰ ਹੇਕ ਲਾਉਣਾ ਬਹੁਤ ਜ਼ਿਆਦਾ ਪਸੰਦ ਹੈ ਠੀਕ ਹੈ